ਭਾਰਤ ਦੇ ਵਿੱਚ ਪੰਜਾਬ ਦੀਆਂ ਰਾਜ ਸ਼ੈਲੀਆਂ ਹੁੰਦੀਆਂ ਹਨ ਪੰਜਾਬ ਦੇ ਵਿੱਚ ਪੰਜਾਬ ਦੀਆਂ ਟਰਡੀਸ਼ਨਲ ਡਰੈਸਾਂ ਹੈਗੀਆਂ ਨੇ ਜਿਸ ਤਰ੍ਹਾਂ ਜੁੱਤੀ ਹੋ ਗਈ ਪੰਜਾਬੀ ਜੁੱਤੀ ਹੋ ਗਈ ਅਤੇ ਫੁਲਕਾਰੀ ਹੋ ਗਈ ਅਤੇ ਜਿਸ ਤਰ੍ਹਾਂ ਕੋਈ ਕੁਰਤ ਕੁੜਤਾ ਪਜ਼ਾਮਾ ਹੋ ਗਿਆ ਪਜ਼ਾਮੀ ਸਟਾਈਲ ਅਸੀਂ ਅਕਸਰ ਦੇਖਦੇ ਹਾਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਅਸੀਂ ਟਰਡੀਸ਼ਨਲ ਡਰੈਸਾਂ ਰੱਖਦੇ ਹੁੰਦੇ ਹਾਂ ਡਰੈਸ ਕੋਡ ਹੁੰਦਾ ਹੈ ਇਹ ਲੇਡੀਜ਼ ਨੇ ਸਭ ਨੇ ਉਹ ਕੀ ਕਹਿੰਦੇ ਆ ਗਿੱਧੇ ਵਾਲਾ ਸੂਟ ਪਾਉਣਾ ਬੰਦਿਆਂ ਨੇ ਪੰਜਾਬੀ ਪੰਜਾਬੀ ਕੁੜਤਾ ਪਜ਼ਾਮਾ ਪਾਉਣਾ ਹੈ ਔਰ ਔਰ ਵੀ ਬੜਾ ਕੁਛ ਅਸੀਂ ਦੱਸਾਂਗੇ ਅਤੇ ਬਾਹਰੋਂ ਸੈਲਾਨੀ ਆਉਂਦੇ ਹਨ ਅਸੀਂ ਉਹਨਾਂ ਨੂੰ ਆਪਣੀ ਸਾਰੀ ਸਫ਼ਲਤਾ ਬਾਰੇ ਸਮਝਾਉਂਦੇ ਹਾਂ ਔਰ ਪੰਜਾਬ ਦੇ ਵਿੱਚ ਕਿਹੋ ਕਿਹੋ ਜਿਹੇ ਪਹਿਰਾਵੇ ਚਲਦੇ ਨੇ ਜਿਸ ਤਰ੍ਹਾਂ ਪਗੜੀ ਜਿਹੜੀ ਹੈ ਪੰਜਾਬ ਦੇ ਵਿੱਚ ਵਿਆਹਾਂ ਸ਼ਾਦੀਆਂ 'ਚ ਪਗੜੀ ਬੜੀ ਚਲਦੀ ਆ ਔਰ ਜਿੰਨੇ ਵੀ ਨਜ਼ਦੀਕੀ ਰਿਸ਼ਤੇਦਾਰ ਹੁੰਦੇ ਉਹਨਾਂ ਨੂੰ ਪਗੜੀਆਂ ਪਾਈਆਂ ਜਾਂਦੀਆਂ ਹਨ ਔਰ ਉਹ ਲੋਕ ਦੇਖਦੇ ਹਨ ਕਿ ਐ ਇੱਥੋਂ ਦਾ ਕਲਚਰ ਵੇਖ ਕੇ ਬੜੇ ਖੁਸ਼ ਹੁੰਦੇ ਹਨ ਔਰ ਉਹ ਲੋਕ ਇਹ ਵੀ ਵੇਖਦੇ ਹਨ ਕਿ ਇੱਥੋਂ ਦਾ ਰੀਤੀ ਰਿਵਾਜ਼ ਔਰ ਇੱਥੇ ਭੰਗੜਾ ਬਹੁਤ ਜ਼ੋਰ ਸ਼ੋਰ ਨਾਲ ਪਾਇਆ ਜਾਂਦਾ ਭੰਗੜਾ ਲੋਕ ਵੇਖਦੇ ਹਨ ਦੂਜੇ ਦੇਸ਼ਾਂ ਨੂੰ ਅਸੀਂ ਅੱਜ ਅੱਜ ਦੇਖਿਆ ਜਾਂਦਾ ਹੈ ਕਿ ਸਾਡੇ ਲੋਕਾਂ ਦਾ ਇੱਥੋਂ ਕਾਫੀ ਸਮਾਨ ਜਿਹੜਾ ਹੈ ਬਾਹਰ ਦੂਸਰੇ ਦੇਸ਼ਾਂ 'ਚ ਜਾਂਦਾ ਹੈ ਔਰ ਕਾਫੀ ਸ ਚੀਜ਼ਾਂ ਜਾਂਦੀਆਂ ਹਨ ਇੱਥੋਂ ਦੇ ਬਰਤਨ ਬੜੇ ਮਸ਼ਹੂਰ ਹਨ ਲੋਕ ਬਰਤਨ ਬਾਹਰੋਂ ਚ ਕਈ ਲੋਕ ਇੱਥੇ ਦੇਖਿਆ ਐੱਨ ਆਰ ਆਈ ਜਿਹੜੇ ਇੰਡੀਅਨ ਹੈਗੇ ਨੇ ਇੱਥੋਂ ਤੇ ਸਪੈਸ਼ਲ ਜਦੋਂ ਘੁੰਮਣ ਆਉਂਦੇ ਹਨ ਤਾਂ ਇੱਥੋਂ ਸਮਾਨ ਜਿਹੜਾ ਜੇ ਬਾਹਰ ਆਪਣੇ ਮੁਲਕ 'ਚ ਲੈ ਕੇ ਜਾਂਦੇ ਹਨ ਕਾਫੀ ਸਾਰਾ ਇੱਥੋਂ ਦਾ ਸਟੀਲ ਦੇ ਬਰਤਨ ਵਗੈਰਾ ਉੱਥੇ ਬਾਹਰ ਜੇਕਰ ਵੇ ਵੇਚੇ ਜਾਂਦੇ ਹਨ